ਸਤਿ ਸ਼੍ਰੀ ਅਕਾਲ ਮੇਰਾ ਨਾਮ ਮਹਾਦੇਵ ਸਿੰਘ ਹੈ ਅਤੇ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਪਿਛਲੇ ਸਾਲ ਸ ਐਸ ਐਨ ਸਿੱਖ ਨੈਸ਼ਨਲ ਕਾਦੀਆਂ ਸਕੂਲ ਵਿੱਚ ਪੜ੍ਹਦਾ ਸੀ ਉੱਥੇ ਮੈਂ ਰਿਲੇਅ ਦੌੜ ਵਿੱਚ ਪਾਰਟੀਸਪੇਟ ਕੀਤਾ ਅਤੇ ਮੈਂ ਉੱਥੋਂ ਡਿਸਟਰਿਕਟ ਖੇਡਣ ਗਿਆ ਮੇਰੇ ਨਾਲ ਮੇਰੇ ਚਾਰ ਫਰੈਂਡਸ ਨੇ ਜਿਹਨਾਂ ਨੇ ਹੋਰ ਖੇਡ ਖੇਡਣ ਗਏ ਮੇਰੇ ਨਾਲ ਮੈਂ ਮੇਰੇ ਪੀ ਟੀ ਟੀਚਰ ਦਾ ਨਾਂ ਸੁਖ ਸੁਖਮਨਪ੍ਰੀਤ ਸਿੰਘ ਸੀ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਇਹ ਖੇਡਣ ਨਾਲ ਮੈਂ ਕਿਤੇ ਵੀ ਕਈ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰ ਸਕਦਾ ਹਾਂ ਮੈਂ ਇਸ ਵੇ ਇਹ ਖੇਡਣ ਨਾਲ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਕਿ ਮੈਂ ਇਹ ਖੇਡ ਨੂੰ ਖੇ ਖੇਡ ਰਿਹਾ ਹਾਂ ਰਿਲੇਅ ਦੌੜ ਮੇਰੀ ਲਾਈਫ ਦੀ ਇੱਦਾਂ ਦੀ ਦੌੜ ਸੀ ਕਿ ਜਿਸ ਨੂੰ ਮੈਂ ਜਿੱਤਣ ਦੀ ਹਰ ਕੋਸ਼ਿਸ਼ ਕੀਤੀ ਪਰ ਮੈਂ ਇਸ ਨੂੰ ਜਿੱਤ ਵੀ ਗਿਆ ਮੈਂ ਡਿਸਟਿਕ ਖੇਡਣ ਗਿਆ ਤਾਂ ਉੱਥੇ ਮੈਂ ਗੋਲਡ ਪ੍ਰਾਪਤ ਕੀਤਾ ਸਟੇਟ ਲੈਵਲ ਵਿੱਚ ਵੀ ਮੈਂ ਸਿਲਵਰ ਪ੍ਰਾਪਤ ਕੀਤਾ ਇਹ ਦੌੜ ਮੈਨੂੰ ਮੇਰੇ ਜੀਵਨ ਬਾਰੇ ਦੱਸਦੀ ਹੈ ਇਹ ਦੌੜ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹ ਦੌੜ ਦੌੜ ਦੌੜ ਨਾਲ ਮੈਂ ਆਪਣੇ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਂ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਇਹ ਦੌੜ ਦੌੜ ਕੇ ਮੈਂ ਡਿਸਟਰਿਕ ਸਟੇਟ ਔਰ ਇੰਟਰਨੈਸ਼ਨਲ ਲੈਵਲ ਤੱਕ ਰਿਲੇਅ ਦੌੜੀ ਹੈ ਅਤੇ ਮੈਨੂੰ ਗੋਲਡ ਪ੍ਰਾਪਤ ਹੋਇਆ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਪਿੰਡ ਦਾ ਅਤੇ ਸਕੂਲ ਦਾ ਨਾਂ ਮਸ਼ਹੂਰ ਕੀਤਾ ਹੈ ਇਹ ਦੌੜ ਦੌੜ ਕੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਮੈਂ ਆਪਣੇ ਘਰ ਆਪਣੇ ਪਰਿਵਾਰ ਦਾ ਵੀ ਨਾਂ ਰੋਸ਼ਨ ਕੀਤਾ ਹੈ ਇਹ ਦੌੜ ਦੌੜ ਕੇ ਬਹੁਤ ਵਧੀਆ ਲੱਗਦਾ ਹੈ ਮੈਨੂੰ ਇਹ ਰਿਲੇਅ ਦੋੜ